ਹਾਂਜੀ ਮੈਨੂੰ ਸਿਲਾਈ ਕਰਨਾ ਅਤੇ ਬੁਣਾਈ ਕਰਨਾ ਦੋਨੇ ਚੀਜ਼ਾਂ ਆਉਂਦੀਆਂ ਨੇ ਮੈਂ ਆਪਣੀ ਪੜੋਸ ਦੀ ਆਂਟੀ ਤੋਂ ਸਿਲਾਈ ਕਰਨਾ ਅਤੇ ਬੁਣਾਈ ਕਰਨਾ ਦੋਨੇ ਚੀਜ਼ਾਂ ਸਿੱਖੀਆਂ ਸੀ ਕਿਉਂਕਿ ਉਹਨਾਂ ਨੂੰ ਬੜੇ ਸੋਹਣੇ ਸਿਲਾਈ ਕਰਨ ਦੇ ਡਿਜ਼ਾਇਨ ਆਉਂਦੇ ਸੀ ਉਹਨਾਂ ਨੂੰ ਕੁੜਤਿਆਂ ਦੇ ਡਿਜ਼ਾਇਨ ਅਤੇ ਉਹਨਾਂ 'ਤੇ ਲੈਸ ਲਾਉਣਾ ਬੜਾ ਸੋਹਣਾ ਆਉਂਦਾ ਸੀ ਅਤੇ ਉਹਨਾਂ ਦੇ ਹੱਥ ਦੀ ਸਫਾਈ ਸੀ ਉਹਨਾਂ ਦੀ ਹੱਥ ਦੀ ਸਫਾਈ ਕਰਕੇ ਉਹਨਾਂ ਤੋਂ ਮੈਂ ਸਿਲਾਈ ਕਰਨੀ ਸਿੱਖੀ ਅਤੇ ਉਹਨਾਂ ਤੋਂ ਮੈਂ ਸਵਟਰ ਬੁਣਨਾ ਅਤੇ ਕਰੋਸ਼ੀਆ ਚਲਾਉਣਾ ਵੀ ਸਿੱਖਿਆ ਅਤੇ ਉਹਨਾਂ ਨੇ ਮੈਨੂੰ ਦੋਨੇ ਚੀਜ਼ਾਂ ਸਿਖਾਈਆਂ ਮੈਂ ਆਪਣੇ ਹਰ ਫੈਸਟੀਵਲ 'ਤੇ ਨਵੇਂ ਨਵੇਂ ਕੱਪੜੇ ਲੈ ਕੇ ਸਿਲਾਈ ਕਰਕੇ ਡਿਜ਼ਾਇਨ ਵਾਲੇ ਸੂਟ ਤੇ ਪਾਉਂਦੀ ਹੈ ਅਤੇ ਸਰਦੀਆਂ ਵਿੱਚ ਮੈਂ ਨਵੇਂ ਨਵੇਂ ਸਵੈਟਰ ਬੁਣਾਈ ਕਰਕੇ ਪਾਉਂਦੀ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਮੈਂ ਆਪਣੀ ਨਵੇਂ ਨਵੇਂ ਡਿਜ਼ਾਇਨ ਵਾਲੇ ਸੂਟ ਪਾਉਂਦੀ ਹੈ ਮੈਂ ਆਪਣੇ ਪੜੋਸ ਦੀ ਸਹੇਲੀ ਨੂੰ ਵੀ ਸਿਲਾਈ ਕਰਨਾ ਅਤੇ ਬੁਣਾਈ ਕਰਨਾ ਸਿਖਾਇਆ ਨੇ ਮੈਨੂੰ ਬੜਾ ਮਜ਼ਾ ਆਉਂਦਾ ਨੇ ਜਦ ਮੈਂ ਇਹ ਕੰਮ ਹੋਰਾਂ ਨੂੰ ਦੱਸਦੀ ਐਂ ਅਤੇ ਉਹ ਵੀ ਮੇਰੇ ਤੋਂ ਬੜੇ ਖੁਸ਼ੀ ਖੁਸ਼ੀ ਚਾਈਂ ਮੇਰੇ ਤੋਂ ਕੰਮ ਸਿੱਖਦੇ ਨੇ ਅਤੇ ਉਹਨਾਂ ਨੂੰ ਬੜਾ ਚੰਗਾ ਲੱਗਦਾ ਨੇ ਮੇਰੇ ਕੋਲ ਆ ਕੇ ਸਿਲਾਈ ਕਰਨਾ ਅਤੇ ਬੁਣਾਈ ਕਰਨਾ ਸਿੱਖਦੇ ਨੇ ਮੈਂ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਡਿਜ਼ਾਇਨ ਬਣਾਉਣਾ ਸਿਖਾਉਂਦੀ ਹੈ ਨਾਲ ਮੈਂ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਬੁਣਾਈ ਕਰਨ ਵਾਲੇ ਡਿਜ਼ਾਇਨ ਵੀ ਸਿਖਾਉਂਦੀ ਹੈ ਅਤੇ ਉਹ ਆਪਣੇ ਹਰ ਫੈਸਟੀਵਲ 'ਤੇ ਨਵੇਂ ਨਵੇਂ ਕੱਪੜੇ ਲੈ ਕੇ ਸਿਲਾਈ ਕਰਕੇ ਪਾਉਂਦੇ ਨੇ